ਪੰਜਾਬ ਤਾਂ ਨਹੀਂ ਵੈਸੇ ਪੂਰੇ ਭਾਰਤ ਵਿੱਚ ਹੀ ਸ਼ੁਰੂ ਤੋਂ ਰੁਜ਼ਗਾਰ ਲੀਏ ਲੋਕ ਰੋਂਦੇ ਆਏ ਹਨ ਅਤੇ ਨਾ ਹੀ ਉਹਨਾਂ ਨੂੰ ਅੱਜ ਤੱਕ ਉਸ ਤਰ੍ਹਾਂ ਦਾ ਰੁਜ਼ਗਾਰ ਮਿਲਿਆ ਜਿਸ ਤਰ੍ਹਾਂ ਦਾ ਉਹਨਾਂ ਨੂੰ ਚਾਹੀਦਾ ਹੈ ਕਿਉਂਕਿ ਭਾਰਤ ਭਾਰਤ ਦੀ ਅਤੇ ਪੰਜਾਬ ਦੀ ਆਬਾਦੀ ਬਹੁਤ ਜ਼ਿਆਦਾ ਹੈ ਉਸ ਹਿਸਾਬ ਨਾਲ ਰੁਜ਼ਗਾਰ ਬਹੁਤ ਹੀ ਜ਼ਿਆਦਾ ਘੱਟ ਹੈ ਅਤੇ ਇਹ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੀ ਸਹੀ ਨੀਤੀਆਂ ਲੈ ਕੇ ਆਉਣ ਅਤੇ ਉਹਨਾਂ ਨੂੰ ਰੁਜ਼ਗਾਰ ਦੇਣ ਹੁਣ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਪਿਛਲੇ ਦਿਨੀ ਮਾਨਸਾ ਜ਼ਿਲ੍ਹੇ ਵਿੱਚ ਕੁੱਲ ਅੱਠ ਪੀਅਨ ਦੀ ਨੌਕਰੀਆਂ ਲੀਏ ਚਾਰ ਹਜ਼ਾਰ ਤੋਂ ਵੀ ਵੱਧ ਐਮਏ ਪਲਸ ਬੀ ਐਡ ਪੜ੍ਹੇ ਹੋਏ ਨੌਜਵਾਨ ਪੇਪਰ ਦੇ ਰਹੇ ਸੀ ਅਤੇ ਹੁਣ ਦੇਖਿਆ ਜਾਵੇ ਤਾਂ ਉਹ ਚਾਰ ਹਜ਼ਾਰ ਨੌਜਵਾਨ ਅੱਠ ਪੋਸਟਾਂ ਪਿੱਛੇ ਹਨ ਅਤੇ ਉਸ ਦੇ ਵਿੱਚੋਂ ਬਾਕੀ ਜਿਹੜੇ ਉਨਤਾਲੀ ਹਜ ਉਨਤਾਲੀ ਸੌ ਬਾਨਵੇਂ ਹੁਣ ਬੱਚੇ ਹੋਣਗੇ ਉਹ ਬੇਰੁਜ਼ਗਾਰ ਹੀ ਰਹਿਣਗੇ ਅਤੇ ਇਸ ਲੀਏ ਹੋਰ ਪੋਸਟਾਂ ਕੱਢਣੀਆਂ ਚਾਹੀਦੀਆਂ ਹਨ ਔਰ ਰੁਜ਼ਗਾਰ ਵਧਾਉਣਾ ਚਾਹੀਦਾ ਹੈ ਨਵੀਆਂ ਨਵੀਆਂ ਕੰਪਨੀਆਂ ਨੂੰ ਪੰਜਾਬ 'ਚ ਸਥਾਪਿਤ ਕਰਨਾ ਚਾਹੀਦਾ ਹੈ ਜਿਸ ਨਾਲ ਰੁਜ਼ਗਾਰ ਵਧੇ ਅਤੇ ਨਾਲ ਦੀ ਨਾਲ ਹੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਗਾਹ ਕਰਨਾ ਚਾਹੀਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਰੁਜ਼ਗਾਰ ਲਈ ਕਿਸ ਪ੍ਰੀਖ ਕੋਈ ਪ੍ਰੀਖਿਆ ਦੇ ਸਕਦੇ ਹੋ ਅਤੇ ਤੁਸੀਂ ਆਪਣਾ ਕੰਮ ਕਿਵੇਂ ਖੋਲ ਸਕਦੇ ਹੋ ਅਤੇ ਉਹਦੀ ਕੀ ਕੀ ਜ਼ਰੂਰਤਾਂ ਹਨ ਅਤੇ ਉਹਦੇ ਕੀ ਕੀ ਕੀ ਕੀ ਉਹਦੇ ਪੜਾਅ ਨੇ